ਜਿਵੇਂ ਕਿ ਆਪਾਂ ਦੇਖਦੇ ਹਾਂ ਵੀ ਮੋਹਾਲੀ ਜ਼ਿਲ੍ਹੇ ਦਾ ਜਿਹੜਾ ਗ੍ਰੋਥ ਰੇਟ ਹੈ ਸਭ ਤੋਂ ਵੱਧ ਹੈ ਸਾਰੇ ਜ਼ਿਲ੍ਹਿਆ ਵਿੱਚੋਂ ਪੰਜਾਬ ਦਿਆਂ ਵਿੱਚੋਂ ਇਸ ਲਈ ਇਸ ਇੱਥੇ ਜ਼ਮੀਨ ਦਾ ਰੇਟ ਵੀ ਸਭ ਤੋਂ ਵੱਧ ਹੈ ਜਿਸ ਨੇ ਸਭ ਤੋਂ ਜ਼ਿਆਦਾ ਆਪਣੇ ਮੋਹਾਲੀ ਜ਼ਿਲ੍ਹੇ ਨੂੰ ਪ੍ਰਭਾਵਿਤ ਕੀਤਾ ਹੈ ਆਰਥਿਕ ਤੌਰ 'ਤੇ ਸਮਾਜਿਕ ਤੌਰ 'ਤੇ ਹਰ ਇਕ ਹਰ ਇੱਕ ਤਿਕ ਤਰੀਕੇ ਨਾਲ ਪ੍ਰਭਾਵਿਤ ਕੀਤਾ ਹੈ ਤਾਂ ਆਰਥਿਕ ਤੌਰ 'ਤੇ ਜਿਵੇਂ ਜ਼ਮੀਨ ਦਾ ਰੇਟ ਵਧਿਆ ਲੋਕਾਂ ਨੇ ਥੋੜ੍ਹਾ ਆਪਣਾ ਥੋੜ੍ਹੀ ਬਹੁਤੀ ਜ਼ਮੀਨ ਵੇਚ ਕੇ ਸੁਖਾਲ਼ੇ ਹੋ ਕੇ ਆਪਣੇ ਕੰਮ ਧੰਦੇ ਸ਼ੁਰੂ ਕਰ ਲਏ ਉਹਦੇ ਨਾਲ਼ ਸਮਾਜਿਕ ਤਬਦੀਲੀਆਂ ਆ ਗਈਆਂ ਬੰਦੇ ਸਮਝੀ ਗਏ ਬੁਨਿਆਦੀ ਢਾਂਚਾ ਵੀ ਬਦਲਿਆ ਗਿਆ ਪਹਿਰਾਵਾ ਵੀ ਬਦਲਿਆ ਗਿਆ ਖਾਣਾ ਪੀਣਾ ਵਧੀਆ ਬਦਲਿਆ ਗਿਆ ਜਿਵੇਂ ਕਿ ਹੁਣ ਆਪਾਂ ਹਿਸਾਬ ਲਾਈਏ ਵੀ ਆਪਣਾ ਮੋਹਾਲੀ ਜ਼ਿਲ੍ਹੇ ਵਿੱਚ ਆਪਣੇ ਜਿੰਨੇ ਵੀ ਪ੍ਰਾਈਵੇਟ ਹੋਸਪਿਟਲ ਹੈ ਬਹੁਤ ਵਧੀਆ ਬਣੇ ਹੋਏ ਨੇ ਪ੍ਰਾਈਵੇਟ ਹੋਸਪਿਟਲ ਵੀ ਬਹਾਰ ਦੇ ਬਹੁਤ ਸਟੇਟਾਂ ਦੇ ਲੋਕ ਆਪਣੇ ਮੋਹਾਲੀ ਜ਼ਿਲ੍ਹੇ ਵਿੱਚ ਆ ਕੇ ਪ੍ਰਾਈਵੇਟ ਹੋਸਪਿਟਲਾਂ ਵਿੱਚ ਇਲਾਜ ਕਰਾਉਂਦੇ ਹਨ ਉਹਦੇ ਨਾਲ਼ ਜਿਹੜੀ ਆਪਣੀ ਆਰਥਿਕ ਤੌਰ 'ਤੇ ਆਰਥਿਕ ਤੌਰ ਤਰੀਕੇ ਤੌਰ ਤਰੀਕੇ ਨੇ ਉਹ ਨਾਲ਼ ਦੁਕਾਨਾਂ ਖੋਲ੍ਹੀਆ ਹੋਈਆ ਨੇ ਉਨ੍ਹਾਂ ਨੇ ਜਾਂ ਆਪਣੇ ਮੋਹਾਲੀ ਜ਼ਿਲ੍ਹੇ ਦਾ ਜਿਵੇਂ ਗ੍ਰੋਥ ਰੇਟ ਆ ਵੱਧ ਹੈ ਬਹੁਤ ਆਪਣੇ ਪ੍ਰਾਈਵੇਟ ਕੰਪਨੀਆਂ ਕੰਮ ਕਰਦੀਆਂ ਨੇ ਬਹੁਤ ਜੰਮੂ ਕਸ਼ਮੀਰ ਸਾਈਡ ਦੇ ਓਧਰ ਵੈਸਟ ਮਹੋਲ ਸਾਈਡ ਦੇ ਬੱਚੇ ਆ ਕੇ ਇੱਥੇ ਸਟੂਡੈਂਟ ਕੰਮ ਕਰਦੇ ਨੇ ਜਿਵੇਂ ਯੂਨੀਵਰਸਿਟੀਆਂ ਖੁੱਲ੍ਹ ਰੱਖੀਆਂ ਨੇ ਇਸ ਨਾਲ਼ ਵੀ ਬਹੁਤ ਫਰਕ ਪੈ ਰਿਹਾ ਜਿਵੇਂ ਆਰਥਿਕ ਤੌਰ 'ਤੇ ਸਭ ਤੋਂ ਜ਼ਿਆਦਾ ਮਜ਼ਬੂਤ ਸਭ ਤੋਂ ਜਿਆਦਾ ਮਹਿੰਗੀ ਜ਼ਮੀਨ ਮੰਨ ਲਓ ਮੋਹਾਲੀ ਜ਼ਿਲ੍ਹੇ ਦੀ ਇਸ ਨਾਲ਼ ਆਰਥਿਕ ਤੌਰ 'ਤੇ ਬਹੁਤ ਫਰਕ ਪੈ ਰਿਹਾ